ਸਤਿ ਸ਼੍ਰੀ ਅਕਾਲ ਜੀ ਗੁਰਦੀਪ ਸਿੰਘ ਜੀ ਬੋਲਦੇ ਹੋ ਮੈਂ ਓਲਾ ਬੁੱਕ ਕੀਤੀ ਸੀ ਮੈਨੂੰ ਤੁਹਾਡਾ ਨੰਬਰ ਮਿਲਿਆ ਜੀ ਉੱਥੋਂ ਮੈਂ ਅੰਮ੍ਰਿਤਸਰ ਸਾਹਿਬ ਜਾਣਾ ਸੀਗਾ ਜੀ ਮੈਨੂੰ ਪਲੀਸ ਦੱਸੋ ਤੁਸੀਂ ਕਿੰਨੇ ਪੈਸੇ ਲੱਗਣਗੇ ਅੰਮ੍ਰਿਤਸਰ ਸਾਹਿਬ ਦੇ ਉੱਥੇ ਨਾਈਟ ਸਟੇਅ ਕਰਨੀ ਹੈ ਜੀ ਅਸੀਂ ਉਹਦੇ ਵਿੱਚ ਕੀ ਕੀ ਖਰਚਾ ਆਊਗਾ ਅਸੀਂ ਵਾਪਸ ਵੀ ਆਉਣਾ ਇੱਕ ਦਿਨ ਰੁਕ ਕੇ ਅਤੇ ਅਸੀਂ ਪੰਦਰਾਂ ਜਣੇ ਹੈ ਸਾਨੂੰ ਕਿਹੜੀ ਗੱਡੀ ਜਿਹੜੀ ਹੈਗੀ ਹੈ ਵਧੀਆ ਰਹੂਗੀ ਘੱਟ ਖਰਚੇ 'ਤੇ ਅਤੇ ਵਧੀਆ ਜਿਹੜਾ ਕੰਫਰਟ ਰਾਈਟ ਹੋਣੀ ਚਾਹੀਦੀ ਹੈ ਸਾਡੀ ਪਲੀਸ ਸਾਨੂੰ ਦੱਸਿਆ ਜਾਵੇ